ਹੈਲੋ ਹਾਂਜੀ ਮੈਨੂੰ ਤੁਹਾਡਾ ਮੰਮੀ ਨੇ ਨੰਬਰ ਦਿੱਤਾ ਸੀ ਉਹ ਕਹਿੰਦੇ ਕੀ ਮੇਰਾ ਵੀਰਾ ਹੈ ਵਧੀਆ ਘੁੰਮਾ ਦੇਵੇਗਾ ਤੈਨੂੰ ਅਸੀਂ ਘੁੰਮਣ ਆਉਣਾ ਹੈ ਪਰਸੋਂ ਅਤੇ ਆਵਾਜਾਈ ਦੇ ਸਾਧਨ ਵਧੀਆ ਹੈ ਇੱਥੇ ਹਾਂਜੀ ਹਾਂਜੀ ਹਾਂਜੀ ਹਾਂਜੀ ਨਵਾਂ ਸ਼ਹਿਰ ਆਉਣਾ ਅਸੀਂ ਘੁੰਮਣ ਅਤੇ ਸਾਨੂੰ ਪਰਸੋਂ ਆਉਣਾ ਹੈ ਸਾਨੂੰ ਜਗ੍ਹਾ ਦੱਸਦੋ ਕਿੱਥੇ ਕਿੱਥੇ ਵਧੀਆ ਰਹਿਣ ਵਾਲੀ

ਵਧੀਆ ਐਨ ਰਹਿਣ 'ਚੋ ਦਿਕੱਤ

ਓਕੇ ਓਕੇ ਹਾਂਜੀ ਮੈਂ ਤੁਹਾਨੂੰ ਦੱਸ ਦਵਾਂਗੀ ਹਾਂਜੀ ਹਾਂਜੀ ਓਕੇ ਪੰਜ ਛੇ ਜਣੇ ਹੈ ਮੇਰੇ ਮਾਤਾ ਪਿਤਾ ਹੈ ਬ੍ਰਦਰ ਹੈ ਮੇਰੇ ਦਾਦੀ ਜੀ ਹੈ ਚਾਚਾ ਚਾਚੀ ਹੈ ਹਾਂਜੀ ਓਕੇ ਕੋਈ ਨਾ ਓਕੇ